ਸਤਿ ਸ਼੍ਰੀ ਅਕਾਲ ਮੈਡਮ ਹਾਂਜੀ ਮੈਡਮ ਮੈਡਮ ਮੈਂ ਨਾ ਚੰਡੀਗੜ੍ਹ ਤੋਂ ਸ਼ਿਫਟ ਹੋਇਆ ਅੰਮ੍ਰਿਤਸਰ ਮੈਂ ਆਪਣੀ ਬੇਟੀ ਵਾਸਤੇ ਸ਼ੋਪਿੰਗ ਕਰਨੀ ਸੀ ਦਰਬਾਰ ਆਪਣੇ ਜੁੱਤੀ ਲੈਣੀ ਪੰਜਾਬੀ ਜੁੱਤੀ ਦੱਸੋ ਤੁਸੀਂ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਦੱਸਿਓ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਡਮ ਅੱਛਾ ਅੱਛ ਅੱਛਾ ਜੀ ਮੈਡਮ ਹਾਂਜੀ ਹਾਂਜੀ ਹਾਂਜੀ ਅੱਛਾ ਮੈਡਮ ਅੱਛਾ ਮੈਡਮ ਠੀਕ ਹੈ ਮੈਡਮ ਬਹੁਤ ਵਧੀਆ ਗੱਲ ਜੇ ਕੋਈ ਲੋੜ ਪਈ ਮੈਂ ਜ਼ਰੂਰ ਤੁਹਾਨੂੰ ਫੋਨ ਕਰੂੰਗਾ ਠੀਕ ਹੈ ਥੈਂਕ ਯੂ